ਹਾਂਜੀ ਮੈਂ ਡਾਂਸਿਗ ਦੀਆਂ ਰੀਲਸ ਵੀ ਦੇਖਦੀ ਆਂ ਸ਼ੋਰਟਸ ਵੀ ਦੇਖਦੀ ਹੈ ਕਿਉਂਕਿ ਡਾਂਸਿੰਗ ਬਹੁਤ ਜਿਆਦਾ ਪਸੰਦ ਹੈ ਮਤਲਬ ਬਚਪਨ ਤੇ ਮੇਰਾ ਸ਼ੌਂਕ ਸੀ ਮੈਨੂੰ ਛੋਟੇ ਹੁੰਦੇ ਮੇਰੇ ਮਮਾ ਅਸੀ ਡਾਂਸ ਸਿਖਾਉਂਦੇ ਹੁੰਦੇ ਸੀ ਘਰੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਸਕੂਲ 'ਚ ਸਕੂਲ ਲੱਗੀ ਹੈਨਾ ਉਦੋਂ ਮਤਲਬ ਵੀ ਸਕੂਲ 'ਚ ਫੰਕਸ਼ਨ ਹੁੰਦੇ ਆ ਈਵੈਂਟ ਕੋਈ ਵੀ ਈਵੈਂਟ ਹੋਣਾ ਮੈਂ ਡਾਂਸਿੰਗ ਵਿੱਚ ਜਰੂਰ ਪਾਰਟੀਸਪੇਟ ਕਰਦੇ ਹੁੰਦੀ ਸੀ ਤੇ ਮਤਲਬ ਇੱਕ ਵਾਰੀ ਕਿ ਅਸੀਂ ਮੈਨੂੰ ਬਹੁਤ ਛੋਟੀ ਸੀ ਉਦੋਂ ਫਸਟ ਕਲਾਸ 'ਚ ਹੋਗੀ ਤੇ ਸਕੂਲ 'ਚ ਨਾ ਫੰਕਸ਼ਨ ਹੋਇਆ ਮਤਲਬ ਉਹਦੇ 'ਚ ਕਿ ਕੁੜੀਆਂ ਨੂੰ ਗਿੱਦੇ ਵਿੱਚ ਪਾਰਟੀਸਪੇਟ ਕਰਵਾਇਆ ਤੇ ਮੈਂ ਕਿਹਾ ਮੈਂ ਵੀ ਲੱਗਣਾ ਤੇ ਪਰ ਮੈਨੂੰ ਟੀਚਰ ਕਹਿੰਦੇ ਤੂੰ ਛੋਟੀ ਆ ਹਨਾ ਮੈਨੂੰ ਨਹੀਂ ਲੈ ਉਸ ਟਾਈਮ ਮੈਨੂੰ ਬਹੁਤ ਫੀਲ ਹੋਈ ਹੈ ਜਿਸ ਕਿ ਮੈਂ ਲੱਗਣਾ ਤਾਂ ਲੱਗਣਾ ਹੀ ਹੈ ਉਸ ਤੋਂ ਬਾਅਦ ਫਿਰ ਮੈਂ ਕਰੇ ਪਰੀਪੇਅਰ ਕਰਨਾ ਸਟਾਰਟ ਕੀਤਾ ਮੇਰੀ ਮਮਾ ਮੈਨੂੰ ਸਿਖਾਉਂਦੇ ਹੁੰਦੇ ਸੀ ਤੇ ਫਿਰ ਐਵੇਂ ਕਰਦੇ ਕਰਦੇ ਮਤਲਬ ਮੈਂ ਡਾਂਸ ਸਿੱਖਿਆ ਉਸ ਤੋਂ ਬਾਅਦ ਮੈਂ ਫਿਰ ਸਕੂਲ 'ਚ ਪਾਰਟੀਸਪੇਟ ਕੀਤਾ ਤੇ ਤੇ ਫਿਰ ਉਸ ਤੋਂ ਬਾਅਦ ਮੈਂ ਪਲੱਸ ਵਨ ਟੂ ਕਾਲਜ ਵਿੱਚ ਕੀਤੀ ਹੈ ਉਦੋਂ ਵੀ ਮੈਂ ਮਤਲਬ ਉਸ ਕਾਲਜ 'ਚ ਵੀ ਡਾਂਸ ਮਤਲਬ ਕਿ ਕਰਦੇ ਹੁੰਦੀ ਸੀ ਹੁਣ ਵੀ ਮੈਂ ਕਰਦੀ ਆ ਪਾਰਟੀਸਪੇਟ ਤੇ ਮੇਰਾ ਫੇਵਰੇਟ ਡਾਂਸਰ ਮੇਰੀ ਮਮਾ ਹੀ ਨੇ ਕਿਉਂਕਿ ਮੈਨੂੰ ਮੇਰੀ ਮਮਾ ਨੇ ਹੀ ਸਿਖਾਇਆ ਡਾਂਸ ਤੇ ਇਸ ਲਈ ਮੇਰੀ ਫੇਵਰੇਟ ਡਾਂਸ ਮਮਾ ਹੀ ਹੈ